ਮੰਨ ਲਓ ਕਬੱਡੀ ਇਹ ਜਿਹੀ ਖੇਡ ਹੈ ਇਹ ਸਾਡੀ ਕੌਮੀ ਖੇਡ ਹੈ ਸ਼ੁਰੂ ਤੋਂ ਚੱਲਦੀ ਆ ਰਹੀ ਆ ਇਹਨੂੰ ਅੰਤਰਰਾਸ਼ਟਰੀ ਪੱਧਰ 'ਤੇ ਨਹੀਂ ਖੇਡਿਆ ਜਾਂਦਾ ਹੈਗਾ ਕੋਈ ਕ੍ਰਿਕਟ ਹੋ ਗਈ ਫੁੱਟਬਾਲ ਹੋ ਗਈ ਹਾਕੀ ਹੋ ਗਈ ਇਹਨੂੰ ਪੱਧਰ 'ਚ ਅੱਗੇ ਲੈ ਕੇ ਜਾ ਰਹੇ ਆ ਅਤੇ ਇਹ ਵਿਰਸੇ ਦੀ ਖੇਡ ਹੈ ਇਹਨੂੰ ਅੱਗੇ ਨਹੀਂ ਲੈ ਕੇ ਜਾ ਰਹੇ ਇਹ ਅਹਿਜੀ ਖੇਡ ਹੈ ਇਹ ਆਪਣੇ ਸਰੀਰ ਨੂੰ ਬਚਾ ਕੇ ਰੱਖ ਰਹੀ ਹੈ ਨਸ਼ੇ ਤੋਂ ਮੁਕਤ ਰੱਖ ਰਹੀ ਹੈ ਅਤੇ ਆਪਸੀ ਭਾਈਚਾਰਾ ਬਣਾਕੇ ਰੱਖ ਰਹੀ ਹੈ ਅਤੇ ਪਹਿਲਾ ਦੇ ਬਜ਼ੁਰਗ ਪੁਰਾਣੇ ਬਜ਼ੁਰਗ ਇਹ ਇਹ ਖੇਡਾਂ ਨੂੰ ਅੱਗੇ ਰੱਖ ਰਹੇ ਸੀਗੇ ਅਤੇ ਹੁਣ ਦੇ ਟਾਇਮ ਦੇ ਵਿੱਚ ਕੋਈ ਕ੍ਰਿਕਟ ਵਗੈਰਾ ਹੋ ਗਈ ਹਾਕੀ ਵਗੈਰਾ ਫੁੱਟਬਾਲ ਹੋ ਗਈ ਅਤੇ ਇਹ ਚੀਜ਼ਾਂ ਨੂੰ ਅੱਗੇ ਰੱਖ ਰਹੇ ਹਾਂ ਤਾਂ ਪੁਰਾਣੇ ਟਾਈਮਾਂ ਦੀਆ ਖੇਡਾਂ ਸੀਗੀਆਂ ਆਪਣੀਆਂ ਜਿਵੇਂ ਕੁਸ਼ਤੀ ਕਬੱਡੀ ਬਲਦਾਂ ਦੀਆਂ ਦੌੜਾਂ ਕਬੂਤਰਬਾਜ਼ੀ ਇਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਲੈ ਗਏ ਹੁਣ ਅੰਤਰਰਾਸ਼ਟਰੀ ਉਹਦੇ ਵਿੱਚ ਨਹੀਂ ਹੈਗੀਆਂ ਇਹ